ਗੀਤ ਸੁਣਨ ਵਿੱਚ ਹਰ ਕਿਸੇ ਨੂੰ ਚੰਗੇ ਲੱਗਦੇ ਹਨ ਪੁਰਾਣੇ ਲੋਕਾਂ ਨੂੰ ਪੁਰਾਣੇ ਗੀਤ ਚੰਗੇ ਲੱਗਦੇ ਹਨ ਅਤੇ ਨਵੇਂ ਲੋਕਾਂ ਨੂੰ ਨਵੇਂ ਗੀਤ ਇਸ ਤਰ੍ਹਾਂ ਦੀ ਸੋਚ ਰੱਖਣਾ ਬਿਲਕੁਲ ਗਲਤ ਹੈ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਪੁਰਾਣੇ ਗੀਤ ਸਿਰਫ ਪੁਰਾਣੇ ਲੋਕਾਂ ਨੂੰ ਹੀ ਚੰਗੇ ਲੱਗਣ ਕਿਉਂਕਿ ਲਿਰਿਕਸ ਗੀਤਾਂ ਨੂੰ ਬਣਾਉਂਦੇ ਆ ਅਤੇ ਲਿਰਿਕਸ ਨਾਲ ਲੋਕ ਰਿਲੇ ਰਿਲੇਟ ਕਰਦੇ ਹਨ ਅਤੇ ਅੱਜ ਦਾ ਯੂਥ ਪੁਰਾਣੇ ਗੀਤਾਂ ਨਾਲ ਸਭ ਤੋਂ ਜ਼ਿਆਦਾ ਰਿਲੇਟ ਕਰ ਸਕਦਾ ਹੈ ਕਿਉਂਕਿ ਪੁਰਾਣੇ ਗੀਤ ਸਭ ਤੋਂ ਜ਼ਿਆਦਾ ਸੋਚ ਕੇ ਲਿਖੇ ਗਏ ਹੈ ਉਸ ਹਰ ਗੀਤ ਦਾ ਤੌਰ ਤੋਂ ਇੱਕ ਮਤਲਬ ਨਿਕਲ ਕਰ ਆਉਂਦਾ ਹੈ ਨਿਕਲ ਕੇ ਆਉਂਦਾ ਹੈ ਅਤੇ ਨਵੇਂ ਗੀਤਾਂ ਵਿੱਚ ਅੱਜ ਕੱਲ੍ਹ ਜ਼ਿਆਦਾ ਧਿਆਨ ਪਾਰਟੀ ਸੌਂਗਜ਼ ਉੱਤੇ ਦਿੱਤਾ ਜਾਂਦਾ ਹੈ ਜਿਹੜੇ ਨੱਚਣ ਲਈ ਤਾਂ ਠੀਕ ਹਨ ਪਰ ਗਾਉਣ ਅਤੇ ਸੁਣਨ ਲਈ ਬਿਲਕੁਲ ਨਹੀਂ ਆਮ ਤੌਰ 'ਤੇ ਮੈਂ ਬਹੁਤ ਜ਼ਿਆਦਾ ਪੁਰਾਣੇ ਗੀਤ ਸੁਣਦਾ ਹਾਂ ਸੁਣਨ ਲਈ ਤਾਂ ਪੁਰਾਣੇ ਗੀਤਾਂ ਤੋਂ ਵਧੀਆ ਕੋਈ ਹੋਰ ਚੀਜ਼ ਮੈਨੂੰ ਨਹੀਂ ਲੱਗਦੀ ਪਰ ਗਾਉਣ ਲਈ ਮੈਂ ਨਵੇਂ ਗੀਤ ਵੀ ਗਾਉਂਦਾ ਜ਼ਿਆਦਾਤਰ ਮੈਂ ਗਾਉਣ ਲਈ ਨਵੇਂ ਗੀਤ ਹੀ ਗਾਉਂਦਾ ਅਰਿਜੀਤ ਸਿੰਘ ਬਹੁਤ ਵਧੀਆ ਗਾਇਕ ਹੈਗਾ ਉਹਨਾਂ ਦੇ ਗੀਤ ਮੈਨੂੰ ਬਹੁਤ ਚੰਗੇ ਲੱਗਦੇ ਹਨ ਇਸ ਲਈ ਮੈਂ ਉਹਨਾਂ ਦੇ ਗੀਤ ਗਾਉਂਦਾ ਹਾਂ ਅਤੇ ਪੁਰਾਣੇ ਗੀਤਾਂ ਵਿੱਚ ਸੁਣਨ ਲਈ ਮੈਂ ਮੁਹੰਮਦ ਰਫੀ ਕਿਸ਼ੋਰ ਕੁਮਾਰ ਦੇ ਵਿੱਚ ਗੀਤ ਵੀ ਸੁਣਦਾ ਮੈਨੂੰ ਨਵੇਂ ਅਤੇ ਪੁਰਾਣੇ ਗੀਤ ਦੋਨੇ ਹੀ ਉੱਨੇ ਪਸੰਦ ਹਨ ਜਿੰਨੇ ਮੈਨੂੰ ਸਮੋਸਿਆਂ ਨਾਲ ਚਨੇ ਪੁਰਾਣੇ ਗੀਤਾਂ ਨੂੰ ਮੈਂ ਸੁਣਦਾ ਅਤੇ ਨਵਿਆਂ ਨੂੰ ਮੈਂ ਗਾਉਂਦਾ ਕਿਉਂਕਿ ਨਵੇਂ ਗੀਤ ਮੇਰੇ ਗਾਣੇ ਆਰਾਮ ਦਿੰਦੇ ਪੁਰਾਣੇ ਗੀਤ ਸੁਣਨ ਲਈ ਬਹੁਤ ਵਧੀਆ ਲੱਗਦੇ ਹਨ ਪਰ ਨਵਿਆਂ ਵਿੱਚ ਗਾਉਣ ਦੀ ਚੰਗੀ ਵਿਧੀ ਬਣ ਜਾਂਦੀ ਹੈ ਮੈਨੂੰ ਗਾਉਣਾ ਪਸੰਦ ਆ ਅਤੇ ਨਵੇਂ ਅਤੇ ਪੁਰਾਣੇ ਗੀਤ ਦੋਵੇਂ ਮੇਰੇ ਦਿਲ ਵਿੱਚ ਵੱਜਦੇ ਹਨ ਇਹ ਜ਼ਰੂਰੀ ਨਹੀਂ ਕਿ ਪੁਰਾਣੇ ਗੀਤ ਪੁਰਾਣੇ ਲੋਕਾਂ ਨੂੰ ਹੀ ਪਸੰਦ ਆਉਣਗੇ ਨਵੇਂ ਲੋਕ ਵੀ ਨਵੇਂ ਨੌਜਵਾਨ ਵੀ ਪੁਰਾਣੇ ਗੀਤਾਂ ਨੂੰ ਸੁਣਦੇ ਹਨ ਅਤੇ ਮੌਜ ਲੈਂਦੇ ਹਨ